ਤਰਨਤਾਨ ਜ਼ਿਲ੍ਹੇ ਵਿੱਚ ਕਣਕ ਝੋਨਾ ਮੱਕੀ ਬਾਜਰਾ ਗੰਨਾ ਆਦਿ ਫਸਲਾਂ ਉਗਾਈਆਂ ਜਾਂਦੀਆਂ ਹਨ ਇਹ ਕਿਸਾਨਾਂ ਨੂੰ ਆਮਦਨ ਪੈਦਾ ਕਰਨ ਵਿੱਚ ਹ ਸਹਾਇਕ ਕਰਦੇ ਹਨ ਅਤੇ ਇਹਨਾਂ ਦੀ ਵਰਤੋਂ ਘਰਾਂ ਦੇ ਵਿੱਚ ਰੋਟੀਆਂ ਆਦਿ ਬ ਰੋਟੀਆਂ ਬਣਾਉਣ ਕ ਝੋਨੇ ਦੀ ਵਰਤੋਂ ਚੌਲ ਅਤੇ ਖੀਰ ਬਣਾਉਣ ਅਤੇ ਗੰਨੇ ਦੀ ਵਰਤੋਂ ਸ਼ੱਕਰ ਅਤੇ ਗੁੜ ਆਦਿ ਬਣਾਉਣ ਵਿੱਚ ਬਣਾ ਕੀਤੀ ਜਾਂਦੀ ਹੈ ਕਿਸਾਨ ਇਹਨਾਂ ਫਸਲਾਂ ਨੂੰ ਹਰ ਸਾਲ ਬੀਜਦੇ ਹਨ ਕਿਹੜੀ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮੰਗ ਝੋਨਾ ਅਤੇ ਕਣਕ ਫਸਲ ਹੁੰਦੀ ਹੁੰਦੀ ਹੈ ਇਹਨਾਂ ਫਸਲਾਂ ਨੂੰ ਉਗਾਉਣ ਵਿੱਚ ਸਭ ਤੋਂ ਪਹਿਲਾਂ ਪੈਲੀ ਨੂੰ ਵਾਹਿਆ ਜਾਂਦਾ ਹੈ ਉਹਨਾਂ ਵਿੱਚ ਬੀਜ ਬੀ ਲਗਾਇਆ ਜਾਂਦਾ ਹੈ ਫਿਰ ਪੈਲੀ ਨੂੰ ਟਾਈਮ ਟਾਈਮ 'ਤੇ ਪਾਣੀ ਲਗਾਇਆ ਜਾਂਦਾ ਹੈ ਅਤੇ ਫਿਰ ਉਹਨਾਂ ਦੀ ਪੈਦਾਵਾਰ ਲਈ ਉਹਨਾਂ ਨੂੰ ਵਧੀਆ ਕੀਟਨਾਸ਼ਕ ਆਦਿ ਦਵਾਈਆਂ ਵੀ ਪਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਉਹਨਾਂ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ ਜਦੋਂ ਫਸਲ ਪੈਦਾ ਹੋ ਜਾਂਦੀ ਹੈ ਤਾਂ ਫਿਰ ਉਸ ਨੂੰ ਉਹਦੀ ਵਾਢੀ ਕੀਤੀ ਜਾਂਦੀ ਹੈ ਅਤੇ ਫਿਰ ਉਸ ਨੂੰ ਮੰਡੀ ਦੇ ਵਿੱਚ ਲਿਜਾ ਕੇ ਵੇਚਿਆ ਜਾਂਦਾ ਹੈ ਕਣਕ ਬੀਜਣ ਵਾਸਤੇ ਗਰਮੀ ਦਾ ਮੌਸਮ ਵਧੀਆ ਹੈ ਅਤੇ ਝੋਨਾ ਬੀਜਣ ਵਾਸਤੇ ਸਰਦੀ ਦਾ ਮੌਸਮ ਬਹੁਤ ਵਧੀਆ ਹੈ